ਭਾਰਤ ਵਿੱਚ ਸੈਲਾਨੀਆਂ ਦੇ ਘੁੰਮਣ ਫਿਰਨ ਲਈ ਕਈ ਸਥਾਨ ਹਨ ਇਹਨਾਂ ਵਿੱਚੋਂ ਧਾਰਮਿਕ ਸਥਾਨ ਅਤੇ ਸੈਰ ਸਪਾਟੇ ਦੇ ਹੋਰ ਵੀ ਕਈ ਸਥਾਨ ਹਨ ਜੇਕਰ ਪੰ ਗੱਲ ਕਰੀਏ ਪੰਜਾਬ ਸੂਬੇ ਦੀ ਤਾਂ ਇੱਥੇ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਵਾਹਗਾ ਬਾਰਡਰ ਅਤੇ ਖਟਕੜ ਕਲਾਂ ਵਿਰਾਸਤ ਏ ਖਾਲਸਾ ਕਿਲਾ ਮੁਬਾਰਕ ਆਦਿ ਹਨ ਅਤੇ ਹੋਰ ਹਿਮਾ ਇਹਦੇ ਨਾਲ ਹੀ ਲੱਗਦਾ ਇੱਕ ਹਿਮਾਚਲ ਪ੍ਰਦੇਸ਼ ਜਿੱਥੇ ਕਿ ਕੁੱਲੂ ਮਨਾਲੀ ਸ਼ਿਮਲਾ ਚੰਬਾ ਧਰਮਸ਼ਾਲਾ ਆਦਿ ਹੈ ਧਰਮਸ਼ਾਲਾ ਨੂੰ ਭਾਰਤ ਦਾ ਸਕੌਟਲੈਂਡ ਵੀ ਕਿਹਾ ਜਾਂਦਾ ਹੈ ਇੱਥੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਅਤੇ ਘੁੰਮਣ ਫਿਰਨ ਦੀ ਬਹੁਤ ਹੀ ਵਧੀਆ ਜਗ੍ਹਾ ਹੈ ਇੱਥੇ ਇਸ ਸ਼ਹਿਰ ਵਿੱਚ ਤੁਹਾਨੂੰ ਪਹਾੜਾਂ ਪਹਾੜ ਹਰਿਆਲੀ ਪਾਣੀ ਅਤੇ ਦਰਖਤਾਂ ਅਤੇ ਬਗੀਚਿਆਂ ਸਮੇਤ ਸਾਰੇ ਖੂਬਸੂਰਤ ਨਜਾਰੇ ਦੇਖਣ ਨੂੰ ਮਿਲਣਗੇ ਅਤੇ ਜੇਕਰ ਗੱਲ ਕਰੀਏ ਇੱਥੇ ਮੰਦਰ ਕੇ ਕਈ ਕਈ ਮੰਦਰ ਹਨ ਜਿਵੇਂ ਕਿ ਚੰਪਾਵਤੀ ਮੰਦਰ ਲਕਸ਼ਮੀ ਨਰਾਇਣ ਮੰਦਰ ਚਮੰਡਾ ਦੇਵੀ ਆਦਿ ਹੋਰ ਕਈ ਸਾਰੇ ਹਨ ਅਤੇ ਜੇਕਰ ਗੱਲ ਕਰੀਏ ਦਿੱਲੀ ਦੀ ਤਾਂ ਦਿੱਲੀ ਲਾਲ ਕਿਲ੍ਹਾ ਅਤੇ ਚਾਰ ਮੀਨਾਰ ਕੁਤਬਮੀਨਾਰ ਅਤੇ ਜੇ ਗੱਲ ਕਰੀਏ ਆਪਾਂ ਉੱਤਰ ਪ੍ਰਦੇਸ਼ ਦੀ ਤਾਂ ਉੱਥੇ ਆਪਾਂ ਨੂੰ ਤਾਜ ਮਹਿਲ ਦੇਖਣ ਨੂੰ ਬਹੁਤ ਸੈਲਾਨੀ ਆਉਂਦੇ ਹਨ ਅਤੇ ਹੋਰ ਇੱਕ ਜਗ੍ਹਾ ਹੈ ਗੋਆ ਜਿੱਥੇ ਕਿ ਵਿਦੇਸ਼ੀ ਸੈਲਾਨੀ ਵੀ ਬਹੁਤ ਜ਼ਿਆਦਾ ਬੀਚ ਦੇਖਣ ਆਉਂਦੇ ਹਨ